ਹੈਲੋ ਵੀਰੇ ਕੀ ਹਾਲ ਨੇ ਮਨਦੀਪ ਬੋਲਦੇ ਹੋ ਮੈਂ ਕੱਲ੍ਹ ਤੋਂ ਸਵੇਰੇ ਤੁਹਾਡੀ ਕੈਬ ਬੁੱਕ ਕਰੀ ਸੀ ਅੰਮ੍ਰਿਤਸਰ ਜਾਣ ਵਾਸਤੇ ਮੈਂ ਅੱਜ ਸਵੇਰੇ ਤੁਹਾਨੂੰ ਫ ਕਾਲ ਕਰਕੇ ਦੱਸਿਆ ਵੀ ਸੀ ਵੀ ਅਸੀਂ ਬਾਰਾਂ ਵਜੇ ਘਰੋਂ ਨਿਕਲ ਜਾਣਾ ਹੈ ਤੁਸੀਂ ਪੂਰੇ ਬਾਰਾਂ ਵੱਜ ਕੇ ਪੰਦਰਾਂ ਮਿੰਟ 'ਤੇ ਬਾਹਰ ਆ ਕੇ ਤਿਆਰ ਰਹਿਓ ਪਰ ਮੈਂ ਤੁਹਾਨੂੰ ਇੱਕ ਵਜੇ ਤੱਕ ਉਡੀਕਦਾ ਰਿਹਾ ਮੈਂ ਤੁਹਾਨੂੰ ਕਈ ਫ਼ੋਨ ਵੀ ਕੀਤੇ ਤੁਹਾਨੂੰ ਚਾਰ ਪੰਜ ਵਾਰ ਫ਼ੋਨ ਕਰਿਆ ਪਰ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਤਾਂ ਮੈਂ ਕੋਈ ਹੋਰ ਕੈਬ ਬੁੱਕ ਕਰ ਲਈ ਥੋ ਅਤੇ ਹੁਣ ਅਸੀਂ ਰਾਹ ਵਿੱਚ ਹਾਂ ਮੈਂ ਤੁਹਾਡੀ ਕੈਬ ਰੱਦ ਕਰ ਦਿੱਤੀ ਹੈ ਅਤੇ ਇਹ ਕੈਬ ਬੁੱਕ ਕਰ ਲਈ ਏ ਜਿਹੜੀ ਕਿ ਤੁਹਾਡੇ ਨਾਲੋ ਹੋਰ ਸਸਤੀ ਪੈ ਗਈ ਤਾਂ ਹੁਣ ਤੁਹਾਨੂੰ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਪੂਰੇ ਬਾਰਾਂ ਵਜੇ ਘਰੋਂ ਨਿਕਲ ਜਾਣਾ ਹੈ ਅਤੇ ਰਾਹ ਵਿੱਚ ਸਾਨੂੰ ਕਈ ਜ਼ਰੂਰੀ ਸਮਾਨ ਵੀ ਲੈਣਾ ਹੈ ਤੁਹਾਡੇ ਕਰਕੇ ਅਸੀਂ ਘਰੋਂ ਪੂਰੇ ਅੱਧੇ ਘੰਟੇ ਲੇਟ ਨਿਕਲੇ ਹਾਂ